ਹਾਂਜੀ ਹਾਂਜੀ ਹਾਂਜੀ ਬਰਨਾਲੇ ਸਟੇਸ਼ਨ ਤੋਂ ਰਾਜੇ ਸਾਰੀਆਂ ਟ੍ਰੇਨਾਂ ਜਾਂਦੀਆਂ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਜਿਵੇਂ ਨੂੰ ਹਜ਼ੂਰ ਸਾਹਿਬ ਨੂੰ ਜਿਹੜੀ ਬਾਇਆ ਧੂਰੀ ਬਾਇਆ ਪਟਿਆਲਾ ਬਾਇਆ ਅੰਬਾਲਾ ਕਿਵੇਂ ਜੀ

ਧੂਰੀ ਤੋਂ ਗੱਡੀ ਜਿਹੜੀ ਚੱਲਦੀ ਆ ਉਹਦੇ ਬਾਰੇ ਪੁੱਛਣਾ ਚਾਹੁੰਦੇ ਹੋ ਧੂਰੀ ਤੋਂ ਜਿਹੜੀ ਗੱਡੀ ਚੱਲਦੀ ਉਹਦੇ ਬਾਰੇ ਪੁੱਛਣੀ ਆ ਧੂਰੀ ਤੋਂ ਵੀ ਚੱਲਦੀ ਆ ਰਾਜੇ ਬਾਇਆ ਧੂਰੀ ਤੋਂ ਬਰਨਾਲਾ ਹੋ ਕੇ ਬਰਨਾਲੇ ਤੋਂ ਰਾਮਪੁਰਾ ਰਾਮਪੁਰੇ ਤੋਂ ਬਠਿੰਡਾ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਹਾਂ ਹਜ਼ੂਰ ਸਾਹਿਬ ਵੀ ਜਾਂਦੀ ਆ ਰਾਜੇ ਉਹ ਬਠਿੰਡਾ ਰਾਮਪੁਰਾ ਬਰਨਾਲਾ ਧੂਰੀ ਸੰਗਰੂਰ ਜਾਖਲ ਜੀਂਦ ਰੋਹਤਕ ਨਿਊ ਦਿੱਲੀ ਮਥੁਰਾ ਆਗਰਾ ਕੈਂਟ ਗਵਾਲੀਅਰ ਭੋਪਾਲ ਇਟਰਾਸੀ ਨਏ ਗਾਓਂ ਅਕੋਲਾ ਵਸੀਮ ਇਹਨਾਂ ਇਥੋਂ ਦੀ ਜਾਂਦੀ ਹੈ ਰਾਜੇ ਇਹ ਸਾਰੀ ਜਿਹੜੀ ਇਹ ਸਾਰੀ ਹਜ਼ੂਰ ਸਾਹਿਬ ਜਾਣਾ ਹਾਂ ਹਾਂ ਦਿੱਲੀ ਵੀ ਜਾ ਸਕਦੇ ਇਹ 'ਚ ਇਹ ਟ੍ਰੇਨ ਦਿੱਲੀ ਹੋ ਕੇ ਹੀ ਜਾਂਦੀ ਹੈ ਜੀ ਇੱਥੇ ਬਠਿੰਡਾ ਬਠਿੰਡਾ ਤੋਂ ਦਿੱਲੀ ਦਿੱਲੀ ਤੋਂ ਫਿਰ ਹ ਹਜ਼ੂਰ ਸਾਹਿਬ ਨਾਂਦੇੜ ਜਾਂਦੀ ਹੈ ਜੀ ਅਤੇ ਤੁਹਾਨੂੰ ਹਜ਼ੂਰ ਹਜ਼ੂਰ ਸਾਹਿਬ ਨੂੰ ਨਾਂਦੇੜ ਨੌਂ ਵੱਜ ਕੇ ਚਾਲੀ ਮਿੰਟ 'ਤੇ ਲਾ ਦੂਗੀ ਹਾਂਜੀ ਔਨਲਾਈਨ ਟਿਕਟ ਬੁੱਕ ਕਰ ਸਕਦੇ ਹੋ ਤੁਸੀਂ ਜੇ ਕਰਨੀ ਹੈ ਤਾਂ ਔਨਲਾਈਨ ਵੀ ਹੋ ਜਾਊਗੀ ਪੇਟੀਐੱਮ ਦੇ ਥਰੂ ਕਰ ਦਿਓ ਜਾਂ ਤੁਸੀਂ ਇਹਦੀ ਰੇਲਵੇ ਦੀ ਸਾਈਡ 'ਤੇ ਜਾ ਕੇ ਕਰ ਲਓ ਜੇ ਤੁਸੀਂ ਇੱਥੇ ਕਾਊਂਟਰ 'ਤੇ ਆ ਕੇ ਲੈਣੀ ਹੈ ਕਾਊਂਟਰ 'ਤੇ ਆ ਕੇ ਵੀ ਲੈ ਸਕਦੇ